ਹਾਂਜੀ ਤੁਸੀਂ ਜੱਗਾ ਸਟੂਡਿਓ ਤੋਂ ਗੱਲ ਕਰ ਰਹੇ ਹੋ ਅੱਛਾ ਉਹ ਫਿਰ ਅਸੀਂ ਇੱਦਾਂ ਗੱਲ ਕਰਨੀ ਸੀਗੀ ਅਸੀਂ ਨਾ ਮਤਲਬ ਆਹਾ ਦਸ ਦਸ ਜੁਲਾਈ ਨੂੰ ਅਸੀਂ ਘਰ ਅਖੰਡ ਪਾਠ ਸਾਹਿਬ ਦਾ ਪਾਠ ਕਰਵਾ ਰਹੇ ਹੋ ਮੇਰੇ ਫਾਦਰ ਦੀ ਰਿਟਾਇਰਮੇਂਟ ਪਾਰਟੀ ਹੈਗੀ ਆ ਤਾਂ ਅਸੀਂ ਦਸ ਤਰੀਕ ਨੂੰ ਤਾਂ ਮਤਲਬ ਅਖੰਡ ਪਾਠ ਦਾ ਦਾ ਭੋਗ ਪਾਉਣਾ ਅਤੇ ਗਿਆਰਾਂ ਤਰੀਕ ਨੂੰ ਅਸੀਂ ਪਾਰਟੀ ਰੱਖ ਰਹੇ ਹੈਂਗੇ ਤਾਂ ਸਰ ਤੁਹਾਨੂੰ ਮਤਲਬ ਅਸੀਂ ਲਾ ਲਉ ਤੁਸੀਂ ਹਿਸਾਬ ਵੀ ਦਸ ਅਤੇ ਗਿਆਰਾਂ ਤਰੀਕ ਲਈ ਅਸੀਂ ਬੁੱਕ ਕਰਨਾ ਤੁਹਾਨੂੰ ਤੁਹਾਡੇ ਕੋਲ ਉਹ ਮਤਲਬ ਫ੍ਰੀ ਹੈ ਮਤਲਬ ਉਹ ਡੇਟਸ ਫ੍ਰੀ ਨੇ ਤੁਸੀਂ ਦੱਸ ਸਕ ਸਕਦੇ ਹੋ ਚੈੱਕ ਕਰਕੇ ਦਸ ਅਤੇ ਗਿਆਰਾਂ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਹੈ ਤੁਹਾਡੇ ਚਾਰਜਸ ਵਗੈਰਾ ਫੇਰ ਦੱਸ ਦਿਉ ਤੁਸੀਂ ਹਾਂਜੀ ਦੋ ਦਿਨਾਂ ਵਾਸਤੇ ਅਖੰਡ ਪਾਠ ਦਾ ਤੁਸੀਂ ਲਾ ਲਉ ਵੀ ਸਾਡਾ ਵੀ ਤਿੰਨ ਦੋ ਤੋਂ ਤਿੰਨ ਘੰਟੇ ਦਾ ਤੁਸੀਂ ਰਿਕੋਰਡ ਕਰਨਾ ਹੋਊਗਾ ਅਤੇ ਆਪਾਂ ਜੇ ਪਾਰਟੀ ਦੀ ਗੱਲ ਕਰੀਏ ਉਹ ਫੇਰ ਦੇਖੋ ਵੀ ਸਵੇਰੇ ਸਵੇਰੇ ਤੁਸੀਂ ਤਿੰਨ ਚਾਰ ਘੰਟੇ ਸਵੇਰੇ ਲਾ ਲਉ ਅਤੇ ਸ਼ਾਮ ਦੀ ਜਿਹੜੀ ਸਾਡੀ ਪਾਰਟੀ ਹੈ ਉਹਦੇ ਤੁਸੀਂ ਚਾਰ ਪੰਜ ਘੰਟੇ ਕਰ ਲਉ ਕਿਉਂਕਿ ਉਦੋਂ ਫਿਰ ਐਂਏ ਆ ਵੀ ਸਾਡਾ ਹਜ਼ਾਰ ਪੰਦਰਾਂ ਸੌ ਬੰਦੇ ਦਾ ਤਾਂ ਇਕੱਠ ਹੋਊਗਾ ਅਤੇ ਮੈਨੂੰ ਲੱਗਦਾ ਤੁਹਾਡੇ ਕੈਮਰਾ ਹਾਂਜੀ ਅਤੇ ਕੈਮਰੇ ਵਗੈਰਾ ਵੀ ਤੁਹਾਡੇ ਇੱਦਾਂ ਨਾ ਜਿੱਦਾਂ ਇੱਕ ਪਾਸੇ ਸ਼ਗਨ ਪੈ ਰਿਹਾ ਹੋਊਗਾ ਇੱਕ ਪਾਸੇ ਰੋਟੀ ਦਾ ਚੱਲ ਰਿਹਾ ਹੋਊਗਾ ਅਤੇ ਤੁਸੀਂ ਰਿਕੋਰਡ ਕਰਨਾ ਮਤਲਬ ਉਹ ਉਹ ਵਾਲੇ ਪਾਸੇ ਉਹ ਤੁਸੀਂ ਫੇਰ ਤੁਹਾਨੂੰ ਪਤਾ ਹੀ ਹੋਊਗਾ ਵਈ ਕਿੰਨੇ ਬੰਦੇ ਚਾਹੀਦੇ ਆ ਤੁਹਾਨੂੰ ਕਿੰਨੇ ਕੈਮਰੇ ਚਾਹੀਦੇ ਆ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਪੰਦਰਾਂ ਹਜ਼ਾਰ ਫੇਰ ਅੱਛਾ ਅੱਛਾ ਪੰਦਰਾਂ ਹਜ਼ਾਰ ਤਾਂ ਸਰ ਦੇਖੋ ਇੱਕ ਦਿਨ ਸਾਡਾ ਪੂਰਾ ਵੀ ਨਹੀਂ ਬਣ ਰਿਹਾ ਅਤੇ ਪੰਦਰਾਂ ਹਜ਼ਾਰ ਤਾਂ ਤੁਸੀਂ ਕੁਛ ਜ਼ਿਆਦਾ ਨਹੀਂ ਕਹਿ ਰਹੇ ਵੀ ਕੁਆਲਿਟੀ ਤਾਂ ਦੇਖੋ ਵਧੀਆ ਹੀ ਹੁੰਦੀ ਆ ਹਾਂਜੀ ਵੀ ਕੈਮਰਾ ਤਾਂ ਆਪਾਂ ਕਿਸੇ ਨੂੰ ਬੁੱਕ ਕਰੀਏ ਹੁਣ ਕੈਮਰਾ ਤਾਂ ਅਗਲਾ ਵਧੀਆ ਹੀ ਲਿਆਏਗਾ ਅਤੇ

ਹਾਂਜੀ ਦੇਖ ਲਉ ਸਰ ਜੇ ਘਟਦੇ ਹੈ ਤਿੰਨ ਚਾਰ ਹਜ਼ਾਰ ਵੀ ਜੇ ਹੋ ਜੇ ਗਾ ਤਾਂ ਚਲੋ ਠੀਕ ਹੈ ਨਹੀਂ ਕੋਈ ਗੱਲ ਨਹੀਂ ਫਿਰ ਹੁਣ ਤੁਸੀਂ ਦੱਸੋ ਸਾਡਾ ਦਸ ਤਰੀਕ ਨੂੰ ਅਸੀਂ ਪਾਠ ਦਾ ਭੋਗ ਪਾਉਣਾ ਅਤੇ ਦਸ ਤਰੀਕ ਨੂੰ ਸਾਡਾ ਹੈਗਾ ਇਹ ਮਾਨਸਾ ਰਹਿ ਜਾਂਦਾ ਮਾਨਸਾ ਸਾਡਾ ਕੇਸਰ ਵਕੀਲ ਵਾਲੀ ਗਲੀ ਹੈ ਨਿਊ ਕੋਰਟ ਰੋਡ 'ਤੇ ਹਾਂਜੀ ਬਾਕੀ ਸਰ ਤੁਹਾਡਾ ਨੰਬਰ ਆ ਗਿਆ ਮੈਂ ਤੁਹਾਨੂੰ ਲੋਕੇਸ਼ਨ ਹੀ ਪੂਰੀ ਉਹ ਉਹ ਕਰ ਦੇਊਂਗੀ ਫੇਰ

ਹਾਂ ਹਾਂ ਸਰ ਉਹ ਕੋਈ ਗੱਲ ਨਹੀਂ ਇੱਕ ਰੂਮ ਤੁਹਾਡੇ ਲਈ ਅਸੀਂ ਅਲੱਗ ਤੋਂ ਇੱਕ ਉਹ ਕਰ ਦਾਂਗੇ ਚਲੋ ਠੀਕ ਹੈ ਸਰ ਫਿਰ ਮੈਂ ਤੁਹਾਨੂੰ ਇੱਕ ਦੋ ਦਿਨ ਰੁਕ ਕੇ ਹੈ ਨਾ ਤੁਹਾਡੀ ਅਡਵਾਂਸ ਜਿੱਦਾਂ ਤੁਸੀਂ ਦੱਸਿਆ ਹੈਗਾ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਸਰ ਉਹ ਹੋਜੇਗਾ ਚਲੋ ਠੀਕ ਹੈ ਸਰ ਫਿਰ ਥੈਂਕ ਯੂ ਓਕੇ